ਹੈਲੋ ਹਾਂਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਮੀਡੀਆ ਪਰਸਨ ਤੋਂ ਬੋਲ ਰਹੇ ਹੋ ਜੀ ਹਾਂਜੀ ਤੁਹਾਡੇ ਪੰਜਾਬ ਵਿੱਚ ਕਿੱਦਾਂ ਦਾ ਅੰਧ ਵਿਸ਼ਵਾਸ ਹੋ ਰਿਹਾ ਜੀ ਅੱਛਾ ਜੀ

ਅੱਛਾ ਜੀ ਹਾਂਜੀ ਤੁਸੀਂ ਵੀ ਅੰਧ ਵਿਸ਼ਵਾਸ 'ਚ ਵਿਸ਼ਵਾਸ ਕਰਦੇ ਹੋ ਜੀ ਅੱਛਾ ਜੀ ਅੱਛਾ ਅੱਜ ਕੱਲ੍ਹ ਦੇ ਵੀ ਮਤਲਬ ਨਵੇਂ ਨਵੇਂ ਆਹ ਅੱਜ ਕੱਲ੍ਹ ਦੇ ਲੋਕ ਜੀ ਹਾਂਜੀ ਪੜ੍ਹੇ ਲਿਖੇ ਲੋਕ ਵੀ ਅੰਧ ਵਿਸ਼ਵਾਸ 'ਚ ਵਿਸ਼ਵਾਸ ਰੱਖਦੇ ਆ ਅੱਛਾ ਜੀ ਅੱਛਾ ਜੀ ਹਾਂਜੀ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਅੰਧ ਵਿਸ਼ਵਾਸ ਬਾਰੇ

ਅੱਛਾ ਜੀ ਅੰਧ ਵਿਸ਼ਵਾਸ ਨੂੰ ਦੂਰ ਕਰਨਾ ਚਾਹੋਂਗੇ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂ ਤੁਸੀਂ ਆਪਦੇ ਆਂਢ ਗਵਾਂਢ ਨੂੰ ਜਿਵੇਂ ਅੰਧ ਵਿਸ਼ਵਾਸ ਤੋਂ ਦੂਰ ਕਰਨ ਦੇ ਜੀ ਕੁਛ ਤਰੀਕੇ ਦੱਸ ਸਕਦੇ ਹੋ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਸਾਨੂੰ ਜੀ ਅੰਧ ਵਿਸ਼ਵਾਸ ਬਾਰੇ ਦੱਸਿਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਤੁਸੀਂ ਦਿੱਤੀ ਜਾਣਕਾਰੀ ਦਿੱਤੀ ਜੀ ਥੈਂਕ ਯੂ ਜੀ